ਸਾਡੇ ਖੇਤਰ ਵਿੱਚ ਇਹੋ ਜਿਹੇ ਕਾਫ਼ੀ ਪ੍ਰੋਗਰਾਮ ਹੁੰਦੇ ਨੇ ਜਿੱਥੇ ਸਾਡੇ ਯੂਵਾ ਨੂੰ ਪੜ੍ਹਾਈ ਦੇ ਸਟਰੈਸ ਤੋਂ ਦੂਰ ਭਜਾਉਣ ਲਈ ਟੂਰਨਾਮੈਂਟ ਕੀਤੇ ਜਾਂਦੇ ਨੇ ਇੱਥੇ ਸਾਰੇ ਯੂਵਾ ਨੂੰ ਪਾਰਟੀਸਪੇਟ ਕਰਵਾਇਆ ਜਾਂਦਾ ਹੈ ਕਿ ਉਹ ਥੋੜ੍ਹੀ ਦੇਰ ਬਾਹਰ ਨਿਕਲਣ ਪੜ੍ਹਾਈ ਦੀ ਦੁਨੀਆ ਤੋਂ ਬਾਹਰ ਨਿਕਲਣ ਅਤੇ ਸਪੋਟਸ ਖੇਡਣ ਸਪੋਟਸ ਖੇਡ ਕੇ ਸਾਡਾ ਮਾਈਂਡ ਫਰੈਸ਼ ਹੁੰਦਾ ਹੈ ਅਤੇ ਅਸੀਂ ਕਾਫ਼ੀ ਕੁਛ ਸਿੱਖਦੇ ਹਨ ਜਿਵੇਂ ਕਿ ਟੀਮ ਵਰਕ ਅਤੇ ਗਰੁੱਪ ਨਾਲ ਕਿਵੇਂ ਖੇਡਿਆ ਜਾਂਦਾ ਹੈ ਸਾਨੂੰ ਸਪੋਟਸਮੈਨ ਸਪਿ ਸਪਿਰਿਟ ਦਾ ਪਤਾ ਲੱਗਦਾ ਹੈ ਸ ਅਸੀਂ ਸਾ ਅਸੀਂ ਆਪਣੇ ਗੁੱਸੇ 'ਤੇ ਕੰ ਕਾਬੂ ਪਾ ਸਕਦੇ ਹਾਂ ਅਸੀਂ ਕਾਫ਼ੀ ਕੁਛ ਇਸ ਤਰ੍ਹਾਂ ਨਵਾਂ ਨਵਾਂ ਸਿੱਖ ਸਕਦੇ ਹਾਂ ਇਹ ਸਪੋਟਸ ਖੇਡਣ ਨਾਲ ਸਾਡਾ ਮ ਦਿਮਾਗ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਜੇ ਅਸੀਂ ਸਪੋਟਸ ਖੇਡਦੇ ਰਹੀਏ ਤਾਂ ਸਾਡਾ ਸਰੀਰ ਬਹੁਤ ਤੰਦਰੁਸਤ ਰਹੇਗਾ ਅਤੇ ਅਸੀਂ ਕੁਛ ਵੀ ਕਰ ਸਕਦੇ ਹਾਂ ਅਤੇ ਸਪੋਟਸ ਖੇਡਣਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਯੁਵਾ ਲਈ ਜਿਹੜਾ ਮੈਂ ਮੰਨਦਾ ਕਿ ਅੱਜ ਕੱਲ੍ਹ ਕਾਫ਼ੀ ਘੱਟ ਹੋ ਗਿਆ ਸਪੋਸਟ ਖੇਡਣਾ ਲੋਕਾਂ ਦਾ